ਸਤਿ ਸ਼੍ਰੀ ਅਕਾਲ ਜੀ ਹੋਰ ਜੀ ਠੀਕ ਹੋ ਹਾਂ ਹਾਂ ਠੀਕ ਨੇ ਹਾਂ ਮੈਂ ਨਾ ਮੈਂ ਸਾਡੇ ਬਟੀਕ ਦਾ ਨਾਮ ਵਾਵਾ ਸੁਣਿਆ ਵੀ ਤੁਸੀਂ ਬਹੁਤ ਵਧੀਆ ਕੱਪੜੇ ਸੀਦੇ ਹੋ ਤੋ ਮੇਰਾ ਵੀ ਵਿਆਹ ਉਣੱਤੀ ਜਨਵਰੀ ਦਾ ਹੈਗਾ ਤੇ ਮੈਂ ਲੈਂਦਾ ਬਣਵਾਉਣਾ ਸੀ ਮੈਂ ਸੁਣਿਆ ਤੁਸੀਂ ਬਹੁਤ ਵਧੀਆ ਬਣਾਉਂਦੇ ਹੋ ਤੁਸੀਂ ਮੇਰਾ ਬਣਾ ਦੋਗੇ ਠੀਕ ਹੈ ਹਾਂ ਤੁਸੀਂ ਇੰਜ ਕਰੋ ਮੇਰਾ ਨਾਪ ਲੈ ਲਓ ਫਿਰ ਮੈਨੂੰ ਮੈਨੂੰ ਥੋੜਾ ਹੈਵੀ ਜਾ ਵਧੀਆ ਲੈਸ ਵਧੀਆ ਲੱਗੀ ਹੋ ਕੋਡੀਆਂ ਵਾਲੀ ਮੈਨੂੰ ਬਹੁਤ ਐਂ ਲੱਗੇ ਵੀ ਮੈਨੂੰ ਵਧੀਆ ਲੱਗੇ ਲਹਿੰਗਾ ਤੇ ਹਾਂ ਸਾਡੇ ਫਿਰ ਤੁਸੀਂ ਨਾ ਇੰਜ ਕਰਿਆ ਜੇ ਸਾਡੇ ਹੋਰ ਮੇਰੇ ਭਾਬੀ ਨੇ ਵੀ ਬਣਵਾਉਣਾ ਤੇ ਮੇਰੀ ਭੈਣ ਨੇ ਵੀ ਤੇ ਮਮੀ ਨੇ ਵੀ ਬਣਵਾਣੇ ਸੂਟ ਉਹਨਾਂ ਨੇ ਵਿਆਹ ਚ ਪਾਣੇ ਆ ਤੁਸੀਂ ਨਾ ਸਾਡਾ ਇੱਕ ਕੰਮ ਨਾ ਸਾਡਾ ਜਲਦੀ ਕੰਮ ਕਰ ਦੇਣਾ ਤੇ ਪੇਮੈਂਟ ਵੀ ਤੁਸੀਂ ਨਾਲ ਹੀ ਲੈ ਲਿਆ ਜੇ ਵੀ ਮੈਂ ਐਡਵਾਂਸ ਦੇ ਦਾਂਗੀ ਚਾਰ ਹਜਾਰ ਕਿਉਂਕਿ ਤੁਸੀਂ ਵੀ ਸਮਾਨ ਲਿਆਣਾ ਹੁੰਦਾ ਨਾ ਹਾਂ ਤਾਂ ਤੁਹਾਨੂੰ ਦੇ ਦਾਂਗੇ ਤੁਹਾਨੂੰ ਹੋਰ ਵੀ ਜਰੂਰਤ ਪੈ ਜੇ ਤਾਂ ਫਿਰ ਮੈਂ ਉਹ ਵੀ ਕਰ ਦਿਆਂਗੀ ਤੇ ਹਾਂ ਤੇ ਮੇਰੀ ਸਹੇਲੀ ਨੇ ਦੱਸਿਆ ਸੀ ਵੀ ਤੁਹਾਡਾ ਬਹੁਤ ਵਧੀਆ ਬੁਟੀਕ ਹੈਗਾ ਵੀ ਸਾਰੇ ਪਬਲਿਕ ਦੇ ਤੁਸੀਂ ਤੁਹਾਡਾ ਰੇਟ ਵੀ ਇਨਾ ਨਹੀਂ ਹੈਗਾ ਤੁਸੀਂ ਵਧੀਆ ਚੰਗੇ ਸੁਭਾਵਦੇ ਆ ਤੇ ਰੇਟ ਵੀ ਤੁਹਾਡਾ ਵਧੀਆ ਹੈਗਾ ਵੀ ਜਿਆਦਾ ਨਹੀਂ ਲੈਂਦੇ ਤੇ ਤੁਹਾਨੂੰ ਵੀ ਮੰਨ ਲਓ ਕਿਸੇ ਦੇ ਸੂਟ ਸੀਂਦੇ ਵੀ ਲੇਟ ਵੀ ਪੈਸੇ ਲੈ ਲੈਂਦੇ ਵੀ ਉਸ ਟਾਈਮ ਨਹੀਂ ਲੈਂਦੇ ਇਸ ਕਰਕੇ ਬਾਈ ਤੁਹਾਡੇ ਕੋਲ ਲਿਆ ਨਾਮ ਵੀ ਤੁਸੀਂ ਨਾ ਬਹੁਤ ਵਧੀਆ ਕੱਪੜੇ ਬਣਾਉਂਦੇ ਹੋ ਇਸ ਲਈ ਮੈਂ ਤੁਹਾਡੇ ਕੋਲ ਹੀ ਆਇਆ ਠੀਕ ਜੀ ਅਸੀਂ ਲਿਆ ਕੇ ਦੇ ਤੁਸੀਂ ਆਪ ਹੀ ਲੈ ਲੋਗੇ ਤੁਹਾਨੂੰ ਪਤਾ ਹੋਏਗਾ ਨਾ ਜ਼ਿਆਦਾ ਵੀ ਤੁਸੀਂ ਬਣਾਉਂਦੇ ਰਹਿੰਦੇ ਹੋ ਕੱਪੜੇ ਤਾਂ ਫਿਰ ਅੱਜ ਕੱਲ ਨਹੀਂ ਵੈਸੇ ਤੁਹਾਨੂੰ ਜਿਆਦਾ ਪਤਾ ਹੋਏਗਾ ਨਾ ਮੈਨੂੰ ਤੇ ਐਨਾ ਪਤਾ ਨਹੀਂ ਹੈਗਾ ਤੁਸੀਂ ਇਸ ਕੱਪੜੇ ਬਣਾਉਂਦੇ ਰਹਿੰਦੇ ਹੋ ਲੈ ਅੱਜਕੱਲ ਕਿਹੜੀ ਚੱਲੀ ਤੁਸੀਂ ਤੁਹਾਨੂੰ ਪਤਾ ਹੋਏਗਾ ਹਾਂਜੀ ਆ ਲਹਿੰਗੇ ਤੇ ਲਟਕਣ ਹਾਂ ਉਹ ਜਿਹੜੇ ਅੱਜਕਲ ਸਾਈਡ ਤੇ ਲੱਗਦੇ ਨਾ ਉਹ ਲਗਾ ਦਿਆ ਜੇ ਹਾਂ ਥੋੜਾ ਲੋਂਗ ਜਿਹਾ ਬਣਵਾਣਾ ਵੀ ਜਿਆਦਾ ਸ਼ੋਟ ਨਹੀਂ ਬਣਾਣਾ ਉਹ ਜਿਹੜਾ ਹਲੇ ਹੁੰਦਾ ਨੀ ਨਾ ਥੋੜਾ ਲੰਬਾ ਹੀ ਬਣਾ ਦਿਓ ਜੇ ਬੜੇ ਹੀ ਮੇਰੀ ਬਹੁਤ ਜਿਆਦਾ ਵਧੀਆ ਲੱਗਦਾ ਉਹ ਸੀ ਵੀ ਆ ਜਾ ਸਾਡਾ ਹਾਂ ਪਿਛਲੇ ਗਲਾ ਜਿਹੜਾ ਡੀਪ ਕਰਦੇ ਆ ਜੇ ਪਿੱਛੇ ਵੀ ਲਟਕਣ ਲੱਗ ਗਏ ਨਾ ਬਹੁਤ ਵਧੀਆ ਲੱਗਦੇ ਨੇ ਡੋਰੀ ਵਾਲਾ ਸੀਅ ਦਿਓ ਜੀ ਫੁਲਕਾਰੀ ਤੇ ਵੀ ਲੈਸ ਵਗੈਰਾ ਤੁਸੀਂ ਲਗਾ ਦਿੰਦੇ ਹੋ ਹਾਂ ਤਾਂ ਉਹ ਵੀ ਲਗਾ ਦਿਆ ਜੇ ਲੈਸ ਵੀ ਤੇ ਫਿਰ ਜਦੋਂ ਬਣਾ ਦੋਗੇ ਨਾ ਤੋ ਫਿਰ ਤੁਹਾਨੂੰ ਹੋਰ ਵੀ ਸੂਟ ਦੇ ਦਿਆਂਗੇ ਤੇ ਸਾਡੇ ਜਿਹੜੇ ਰਿਸ਼ਤੇਦਾਰ ਰਹਿਣ ਉਹਨਾਂ ਦੀ ਤੁਸੀਂ ਬਣਾ ਦਿਆ ਤੁਹਾਡੀ ਮਿਹਰਬਾਨੀ ਹੋਏਗੀ ਹਾਂਜੀ ਦੇ ਦਿਓ

ਹਾਂ ਤੇ ਮੇਰੇ ਸੂਟ ਵੀ ਹੈਗੇ ਲਹਿੰਗਾ ਤਾਂ ਮੈਂ ਬਣਵਾਉਣਾ ਹੀ ਹ ਮੇਰੇ ਸੂਟ ਵੀ ਹੈਗੇ ਛੇ ਸੱਤ ਸੂਟ ਉਹਨਾਂ ਨੂੰ ਵੀ ਸੀਨਾ ਤਾਂ ਤੁਸੀਂ ਉਹ ਵੀ ਬਣਾ ਦਿਆ ਜੇ ਠੀਕ ਐ ਤੁਸੀਂ ਇਨੇ ਉਣੱਤੀ ਜਨਵਰੀ ਤੱਕ ਮੇਰਾ ਬਣਾ ਦੋਗੇ ਬਈ ਹੋ ਜਾਣਗੇ ਮੇਰਾ ਕੰਮ ਹੋ ਜਾਏਗਾ ਹਾਂਜੀ ਠੀਕ ਐ ਜੀ ਹਾਂਜੀ ਠੀਕ ਹ ਹਾਂ ਸਹੀ ਤੁਸੀਂ ਪੂਰੇ ਪੈਸੇ ਪੇਮੈਂਟ ਵਗੈਰਾ ਦੱਸ ਦੇਣਾ ਤੇ ਤੁਹਾਡੀ ਟੋਟਲ ਪੇਮੈਂਟ ਕਿੰਨੀ ਹੋਊਗੀ ਤੇ ਮੈਨੂੰ ਜਰੂਰ ਦੱਸ ਦੇਣਾ ਫਿਰ ਅਸੀਂ ਉਹ ਤੁਹਾਨੂੰ ਦੇ ਦਾਂਗੇ ਨਾ ਮੈਨੂੰ ਦੱਸ ਦਿਆ ਜੇ ਧੰਨਵਾਦ ਜੀ ਠੀਕ ਹੈ ਜੀ